ਸਮਾਜ ਭਲਾਈ ਦਾ ਮੁੱਦਾ ਹੈਗਾ ਸਭ ਨਾ ਪਹਿਲੇ ਦਾਨ ਦਾਨ ਕਰਨਾ ਸਮਾਜ ਸੇਵਾ ਕਰਨਾ ਸਕੱਤੀਕਰਨ ਕਰਨਾ ਦਾਨ ਸਾਨੂੰ ਸਾਡੇ ਗ੍ਰੰਥਾਂ ਵਿੱਚ ਆਉਂਦਾ ਦਾਨ ਕਰਨਾ ਕਰਨ ਕਰਾਨ ਸਿੱਖਿਆ ਜਾਵੇ ਕਰਨ ਕਰਨ ਹੁੰਦਾ ਸੀ ਪਾਂ ਪਾਂਡਵਾਂ ਦਾ ਭਰਾ ਕਰਨ ਸੀ ਉਹ ਮਹਾਂ ਮਹਾਂਦਾਨੀ ਸੀ ਉਹਨੇ ਉਹਦੇ ਘਰ ਆਏ ਠਾਕੁਰ ਜੀ ਆਏ ਮੈਂ ਭਗਵਾਨ ਕ੍ਰਿਸ਼ਨ ਆਏ ਤੇ ਉਹ ਦਾਨ ਕਰਨ ਲੱਗਿਆ ਤਾਂ ਉਹਨੇ ਇੱਕਦਮ ਵੇਖਿਆ ਕਿ ਬਾਹਰ ਬੜਾ ਬਾਰਿਸ਼ ਹੋ ਰਹੀ ਹੈ ਕ੍ਰਿਸ਼ਨ ਜੀ ਅਤੇ ਅਰਜੁਨ ਜੀ ਆਏ ਤੇ ਦਾਨ ਕਰਨ ਲੱਗਿਆਂ ਉਹਨੂੰ ਕਿਹਾ ਚੰਦਨ ਦੀਆਂ ਲੱਕੜੀਆਂ ਚਾਹੀਦੀਆਂ ਕਹਿੰਦਾ ਲਓ ਜੀ ਹੁਣੇ ਲਵੋ ਉਹਨੇ ਆਪਣਾ ਚੰਦਨ ਦਾ ਬਣਿਆ ਹੋਇਆ ਬੈੱਡ ਸਾਰਾ ਤੋੜ ਦਿੱਤਾ ਅਤੇ ਉਸੇ ਵੇਲੇ ਸੁੱਕੀਆਂ ਲੜਕਾਂ ਲੱਕੜੀਆਂ ਜਿਹੜੀਆਂ ਕ੍ਰਿਸ਼ਨ ਜੀ ਦੇ ਹਵਾਲੇ ਕੀਤੀਆਂ ਕਿ ਲਓ ਪ੍ਰਭੂ ਇਹ ਤੁਹਾਨੂੰ ਹੁਣੇ ਬਾਹਰ ਤੇ ਮੀਂਹ ਪੈ ਰਿਹਾ ਇਹ ਲਓ ਤੁਸੀਂ ਦਾਨ ਲੱਕੜਾਂ ਮੰਗੀਆਂ ਚੰਦਨ ਦੀਆਂ ਇਹ ਲਓ ਲ ਲੱਕੜ ਹਾਜ਼ਰ ਆ ਮਤਲਬ ਕਿ ਇੰਨਾ ਉਹਨੇ ਆਪਣੇ ਸਰੀਰ 'ਤੇ ਕਵਚ ਪਾਇਆ ਹੋਇਆ ਜਿਹੜਾ ਉਹ ਵੀ ਉਹਨੇ ਮਗ ਭਗਵਾਨ ਕ੍ਰਿਸ਼ਨ ਮੰਗਣ 'ਤੇ ਦਾਨ ਕਰ ਦਿੱਤਾ ਸੀ ਇਸ ਵਿੱਚ ਦਾਨ ਅਸੀਂ ਦੇਖਦੇ ਹੀ ਹਾਂ ਕਿ ਜਿਹਨੂੰ ਲੋੜ ਪਵੇ ਗੁਰਦੁਆਰਿਆਂ 'ਚ ਦੂਜੇ ਪੰਜਾਬੀ ਦਾਨ ਕਰਨ 'ਚ ਵੈਸੇ ਵੀ ਬੜੇ ਲੰਗਰ ਲਾਉਣ ਵਿੱਚ ਦਾਨ ਕਰਨ 'ਚ ਸਭ ਨਾਲੋਂ ਅੱਗੇ ਹਨ ਸਾਨੂੰ ਤਾਂ ਬੜਾ ਇਹ ਬੜੀ ਅੱਛੀ ਗੱਲ ਹੈ ਇਸੇ ਤਰ੍ਹਾਂ ਹੀ ਸਮਾਜ ਸੇਵਾ ਅਤੇ ਏ ਸ਼ਕਤੀਕਰਨ ਜਿਹੜੀ ਜੇ ਕਿਸੇ ਜੇ ਮੰਨ ਲਓ ਪਿੰਗਲਵਾੜਾ ਹੈਗਾ ਪਿੰਗਲਵਾੜੇ ਵਿੱਚ ਕਿੰਨੇ ਅਨਾਥ ਬੱਚਿਆਂ ਨੂੰ ਰੋਟੀ ਪਾਣੀ ਕੱਪੜਾ ਦਿੱਤਾ ਜਾਂਦਾ ਹੈ ਅਤੇ ਕਿਉਂਕਿ ਜੇ ਸਾਡੇ ਕੋਲ ਜ਼ਿਆਦਾ ਉਹ ਫੂਡ ਹੈਗਾ ਹੈ ਹੈਗੀ ਹੈ ਸਾਨੂੰ ਜੇ ਸਾਡੇ ਕੋਲ ਵੀ ਕੋਈ ਐਕਸੈਸ ਚੀਜ਼ ਹੈਗੀ ਤਾਂ ਸਾਨੂੰ ਵੀ ਚਾਹੀਦਾ ਕਿ ਅਸੀਂ ਪਿੰਗਲਵਾੜੇ 'ਚ ਦਾਨ ਕਰੀਏ ਤਾਂ ਕਿ ਜੇ ਅਸੀਂ ਨਹੀਂ ਖਾ ਸਕੇ ਤਾਂ ਉਹ ਖਾ ਸਕਣ ਜੇ ਅਸੀਂ ਕੋਈ ਵੱਧ ਕੱਪੜਾ ਹੈਗਾ ਜੇ ਅਸੀਂ ਨਹੀਂ ਪਾ ਸਕਦੇ ਉਹ ਪਾ ਸਕਣ ਇਸੇ ਤਰ੍ਹਾਂ ਸਮਾਜ ਦੇ ਵਿੱਚ ਭਲਾ ਹੋਵੇ ਅਤੇ ਸਾਰੇ ਇਕੁਅਲ ਸਾਰੀ ਜਿਹੜੇ ਨੀਵੇਂ ਵਰਗ ਹੈਗਾ ਉਹ ਵੀ ਥੋੜ੍ਹਾ ਉੱਪਰ ਆ ਜਾਵੇ ਅਤੇ ਸਾਰੇ ਇਕੁਅਲ ਹੋ ਜਾਣਗੇ ਇਸੇ ਤਰ੍ਹਾਂ ਬਬ ਸਮਾਜ ਦੀ ਭਲਾਈ ਹਰ ਕਿਸੇ ਮਨੁੱਖ ਨੂੰ ਕਰਨੀ ਚਾਹੀਦੀ ਹੈ ਸ਼ੁਕਰੀਆ